ਵੇਟਰ ਗੱਲ ਸੁਣੋ ਇੱਧਰ ਹਾਂ ਬੇਟਾ ਦੇਖੋ ਅਸੀਂ ਤੁਹਾਡੇ ਕੋਲੋਂ ਔਡਰ ਕੀਤਾ ਸੀ ਇਹ ਡੋਸਾ ਇਹ ਡੋਸਾ ਖਾਂ ਦੇਖੋ ਇਹਦੇ ਵਿੱਚੋਂ ਨਾ ਕੋਈ ਪਨੀਰ ਹੈ ਨਾ ਕੋਈ ਅਨੀਅਨ ਹੈ ਇਹਦੇ ਵਿੱਚ ਕੀ ਹੈ ਐਨੀ ਸਮੈੱਲ ਆ ਰਹੀ ਹੈ ਸਬਜ਼ੀ ਵਿੱਚੋਂ ਵੀ ਸਬਜ਼ੀਆਂ ਕੱਚੀਆਂ ਸਾਂਬਰ ਵਿੱਚ ਚਟਨੀ ਵੀ ਖਰਾਬ ਹੈ ਐਸਾ ਤੁਸੀਂ ਕਸਟਮਰ ਨੂੰ ਡੀਲ ਕਰਦੇ ਪਏ ਹੋ ਅਸੀਂ ਬੜਾ ਵੱਡਾ ਨਾਮ ਸੁਣ ਕੇ ਆਏ ਸੀ ਕਿ ਤੁਹਾਡਾ ਰੈਸਟੋਰੈਂਟ ਦਾ ਨਾਮ ਬੜਾ ਅੱਛਾ ਹੈਗਾ ਸਾਨੂੰ ਦੱਸਿਆ ਸੀ ਕਿਸੇ ਨੇ ਅਸੀਂ ਉਹਨਾਂ ਦੀ ਰੈਫਰੈਂਸ 'ਤੇ ਤੁਹਾਡੇ ਹੋਸਟ ਰੈਸਟੋਰੈਂਟ 'ਚ ਆਏ ਹਾਂ ਔਰ ਅੱਗੋਂ ਤੁਹਾਡੀ ਇਹੋ ਜਿਹੀ ਡਿਲਿੰਗ ਹੈ ਦੁਬਾਰਾ ਕੌਣ ਆਏਗਾ ਤੁਹਾਡੇ ਰੈਸਟੋਰੈਂਟ 'ਤੇ ਹੁਣੇ ਜਾਉ ਇਹਨੂੰ ਚੇਂਜ ਕਰਕੇ ਲੈ ਕੇ ਆਉ ਨਹੀਂ ਤਾਂ ਅਸੀਂ ਤੁਹਾਡੇ ਮੈਨੇਜਰ ਨੂੰ ਸ਼ਿਕਾਇਤ ਕਰ ਦੇਣੀ ਆ